ਪੰਦਰਾਂ ਅਗਸਤ ਉੱਨੀ ਸੌ ਪੰਜਾਹ ਛੱਬੀ ਜਨਵਰੀ ਉੱਨੀ ਸੌ ਸੰਤਾਲੀ ਦੋ ਸਤੰਬਰ ਦੋ ਹਜ਼ਾਰ ਦੋ ਤਿੰਨ ਨਵੰਬਰ ਉੱਨੀ ਸੌ ਅਠਾਨਵੇਂ ਛੇ ਦਸੰਬਰ ਉੱਨੀ ਸੌ ਨੱਬੇ